ਮੀਡੀਆ ਅਤੇ ਸਰਕਾਰ ਦੇ ਆਪਸੀ ਅ ਗਤੀਵਿਧੀਆਂ ਦੇ ਵਿੱਚ ਕਹਿ ਦਿਓ ਕਿ ਆਮ ਸਮਾਜ ਨੂੰ ਕੋਈ ਜ਼ਿਆਦਾ ਲਾਭ ਤਾਂ ਨਹੀਂ ਹੁੰਦਾ ਜਿੱਥੋਂ ਤੱਕ ਦੇਖਣ ਨੂੰ ਆਇਆ ਹੈ ਨਹੀਂ ਹੁੰਦਾ ਅਤੇ ਇਸ ਸੰਬੰਧ ਦੇ ਵਿੱਚ ਮੇਰਾ ਕੋਈ ਨਿੱਜੀ ਅਨੁਭਵ ਵੀ ਨਹੀਂ ਹੈ ਔਰ ਮੈਨੂੰ ਇਹਦੇ ਬਾਰੇ ਕੁਝ ਜ਼ਿਆਦਾ ਜਾਣਕਾਰੀ ਵੀ ਨਹੀਂ ਹੈ